ਨਮਸਕਾਰ ਜੀ ਮੈਂ ਸੁਨੀਤਾ ਰਾਣੀ ਬੋਲ ਰਹੀ ਹਾਂ ਮੈਨੂੰ ਇੱਕ ਵਿਦੇਸ਼ੀ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਈ ਹੈ ਪਰ ਮੇਰੇ ਪਾਸਪੋਰਟ ਦੀ ਵੈਧਤਾ ਖਤਮ ਹੋ ਚੁੱਕੀ ਹੈ ਮੈਂ ਇਸ ਦਾ ਨਵੀਨੀਕਰਨ ਕਰਨਾ ਚਾਹੁੰਦੀ ਹਾਂ ਮੈਂ ਚਾਹੁੰਦੀ ਹਾਂ ਕਿ ਪਾਸਪੋਰਟ ਦੇ ਨਵੀਨੀਕਰਨ ਦਾ ਕੰਮ ਖੁਦ ਪੂਰਾ ਕਰਾਂ ਤਾਂ ਜੋ ਮੈਨੂੰ ਭਵਿੱਖ ਵਿੱਚ ਅਜਿਹੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੀ ਤੁਸੀਂ ਆਪਣੇ ਤਜਰਬੇ ਦੇ ਅਧਾਰ 'ਤੇ ਮੇਰੀ ਮਦਦ ਕਰ ਸਕਦੇ ਹੋ